ਸਾਡੇ ਰਾਜ ਵਿੱਚ ਪੰਜਾਬੀ ਸਿੱਖਿਆ ਪ੍ਰਣਾਲੀ ਜਿਹੜੀ ਹੈ ਇਹ ਇਹ ਬਹੁਤ ਅਹਿਮ ਭੂਮਿਕਾ ਇਹਦੀ ਕਿਉਂਕਿ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਅਤੇ ਸਾਨੂੰ ਪੰਜਾਬੀ ਪੜ੍ਹਨੀ ਲਿਖਣੀ ਜ਼ਰੂਰੀ ਹੈ ਕਿਉਂਕਿ ਸਾਰਾ ਕੁਛ ਹੀ ਜੋ ਵੀ ਹੈ ਪੰਜਾਬੀ ਦੇ ਵਿੱਚ ਲਿਖਿਆ ਹੁੰਦਾ ਹੈ ਜੇ ਆਪਾਂ ਬੱਸ ਸਟੈਂਡ 'ਤੇ ਜਾਂਦੇ ਹਾਂ ਤਾਂ ਉੱਥੇ ਵੀ ਪੰਜਾਬੀ ਲਿਖੀ ਹੁੰਦੀ ਹੈ ਅਤੇ ਜੇ ਕਿਤੇ ਸਾਈਨਬੋਰਡ ਆ ਉੱਥੇ ਵੀ ਪੰਜਾਬੀ ਲਿਖੀ ਹੁੰਦੀ ਹੈ ਕਿਉਂਕਿ ਜੇ ਸਾਨੂੰ ਪੰਜਾਬੀ ਪੜ੍ਹਨੀ ਆਵੇਗੀ ਤਾਂ ਹੀ ਅਸੀਂ ਪੜ੍ਹ ਸਕਾਂਗੇ ਸਾਡੇ ਧਾਰਮਿਕ ਗ੍ਰੰਥ ਸਾਡੀਆਂ ਧਾਰਮਿਕ ਪੁਸਤਕਾਂ ਸਾਰੀਆਂ ਪੰਜਾਬੀ ਵਿੱਚ ਹਨ ਗੁਰੂ ਗ੍ਰੰਥ ਸਾਹਿਬ ਪੂਰਾ ਪੰਜਾਬੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਜੇ ਸਾਨੂੰ ਪੰਜਾਬੀ ਭਾਸ਼ਾ ਪੜ੍ਹਨੀ ਆਵੇਗੀ ਤਾਂ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ੍ਹ ਸਕਦੇ ਹਾਂ ਅਤੇ ਜੇਕਰ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਹੈ ਤਾਂ ਫਿਰ ਸਾਨੂੰ ਇਹਦੇ ਨਾਲ ਬਹੁਤ ਔਖਾ ਹੈ ਇਹ ਸਿੱਖਿਆ ਦੇ ਵਿੱਚ ਜ਼ਰੂਰੀ ਹੈ ਕਿਉਂਕਿ ਇਹਦੇ ਜੇ ਪੰਜਾਬੀ ਨਹੀਂ ਆਉਂਦੀ ਤਾਂ ਫਿਰ ਸਾਡਾ ਜਿਹੜਾ ਵਜੂਦ ਉਹ ਖਤਮ ਹੋ ਜੂਗਾ ਕਿਉਂਕਿ ਅਸੀਂ ਫਿਰ ਆਪਣੇ ਆਪ ਕੁਛ ਨਹੀਂ ਕਰ ਸਕਦੇ ਭਾਸ਼ਾ ਦੂਜੀਆਂ ਵੀ ਠੀਕ ਹੈ ਹੋਰ ਵੀ ਸਿੱਖਣੀਆਂ ਚਾਹੀਦੀਆਂ ਪਰ ਪੰਜਾਬੀ ਲਾਜ਼ਮੀ ਹੁਣ ਸਿ ਸਿੱਖਣੀ ਪੈ ਗਈ ਸਾਡੀ ਮਾਤ ਭਾਸ਼ਾ ਹੈ ਹਾਂਜੀ